ਤੁਹਾਡੀ ਰਸੋਈ ਵਿੱਚ ਬਿਜਲੀ ਦੇ ਬਹੁਤ ਸਾਰੇ ਉਪਕਰਣ ਉਪਯੋਗੀ ਹੋ ਸਕਦੇ ਨੇ ਖਾਸ ਕਰ ਆਧੁਨਿਕ ਜੀਵਨ ਸ਼ੈਲੀ ਵਿੱਚ ਪੁਰਾਣੇ ਦਿਨਾਂ ਨਾਲ ਤੁਲਨਾ ਕਰੀਏ ਤਾਂ ਤਜਰਬਾ ਕਾਫੀ ਵੱਖਰਾ ਹੋ ਗਿਆ ਹੈ ਕਿਉਂਕਿ ਨਵੇ ਤਕਨੀਕੀ ਸਾਧਨ ਨੇ ਰੋਜ਼ਾਨਾ ਕੰਮ ਆਸਾਨ ਬਣਾ ਦਿੱਤੇ ਨੇ ਬਿਜਲੀ ਦੇ ਮੁੱਖ ਕਾਰਨ ਕਿਹੜੇ ਨੇ ਮਿਕਸਰ ਗਰਾਇੰਡਰ ਮਸਾਲੇ ਪੀਸਣ ਪੇਸਟ ਬਣਾਉਣ ਲੱਸੀ ਜੂਸ ਅਤੇ ਹੋਰ ਕਈ ਚੀਜ਼ਾਂ ਲਈ ਕੰਮ ਆਉਂਦਾ ਹੈ ਦੂਸਰਾ ਇਲੈਕਟਰਿਕ ਤੰਦੂਰ ਰੋਟੀ ਨਾਨ ਟਿੱਕਾ ਬਣਾਉਣ ਦੇ ਕੰਮ ਆਉਂਦਾ ਹੈ ਤੀਸਰਾ ਇੰਡਕਸ਼ਨ ਕੁਕਟਾਪ ਗੈਸ ਦੀ ਬਜਾਏ ਬਿਜਲੀ 'ਤੇ ਚੱਲਣ ਵਾਲਾ ਸੁਰਕਸ਼ਿਤ ਅਤੇ ਤੇਜ਼ ਕੁਕਿੰਗ ਉਪਕਰਣ ਚੌਥਾ ਮਾਈਕਰੋਵੇਵ ਅਵਨ ਖਾਣਾ ਗਰਮ ਕਰਨ ਬੇਕਿੰਗ ਅਤੇ ਹੋਰ ਕਈ ਚੀਜ਼ਾਂ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਪੰਜਵਾਂ ਇਲੈਕਟ੍ਰਿਕ ਕੈਟਲ ਛੇਵਾਂ ਇਲੈਕਟ੍ਰਿਕ ਕਰਾਈਜ ਕੁਕਰ ਸੱਤਵਾਂ ਡਿਸ਼ਵੋਸ਼ਰ ਇੱਦਾਂ ਹੋਰ ਵੀ ਕਈ ਨੇ ਜੋ ਆਧੁਨਿਕ ਜੀਵਨ ਵਿੱਚ ਉਪ ਉਪਲਬਧ ਕੀਤੇ ਜਾਂਦੇ ਹਨ